ਪੰਜਾਬੀ ਭਾਸ਼ਾ ਜਿਹੜੀ ਸਾਡੀ ਇਹ ਸ਼ੁਰੂ 'ਚ ਜਿਵੇਂ ਪਹਿਲਾਂ ਆਰੀਆ ਲੋਕ ਆਏ ਉਹਨਾਂ ਨੇ ਆਪਣੀ ਭਾਸ਼ਾ ਦੇ ਹਿਸਾਬ ਨਾਲ ਇਹਨੂੰ ਲਾਗੂ ਕੀਤਾ ਫਿਰ ਸਿੰਧੂ ਲੋਕ ਆਏ ਉਹਨਾਂ ਨੇ ਵੀ ਇਹਨਾਂ ਨੂੰ ਕੁਛ ਵਾਡ ਸਾਨੂੰ ਦਿੱਤੇ ਇਸ ਤੋਂ ਬਾਅਦ ਗੁਰੂਆਂ ਨੇ ਟੈਮ ਪਾ ਕੇ ਗੁਰੂ ਆਏ ਗੁਰੂਆਂ ਨੇ ਸਾਨੂੰ ਗੁਰਮੁਖੀ ਲਿਪੀ ਦਿੱਤੀ ਅਤੇ ਗੁਰਮੁਖੀ ਲਿਪੀ ਦੇ ਨਾਲ ਨਾਲ ਇਹ ਸਾਡੀ ਪੰਜਾਬੀ ਭਾਸ਼ਾ ਅੱਗੇ ਵਧੀ ਜੋ ਮਿਕਸ ਹੋਈ ਸਾਡੇ ਲੋਕਾਂ ਨੇ ਇਹਦੇ ਵਿੱਚ ਲਿਖਤਾਂ ਲਿਖੀਆਂ ਕਿਸੇ ਨੇ ਕਵਿਤਾਵਾਂ ਕਹਾਣੀਆਂ ਗੀਤ ਅਤੇ ਬਾਤਾਂ ਬੁਝਾਰਤਾਂ ਅਤੇ ਗੁਰਬਾਣੀ ਅਤੇ ਕਵਗਾਨੀ ਵੀ ਇਹਦੇ ਵਿੱਚ ਗੁਰਬਾਣੀ ਲਿਖੀ ਸਿੱਖਾਂ ਨੇ ਵੀ ਗੁਰੂਆਂ ਨੇ ਵੀ ਅਤੇ ਇਸ ਤੋਂ ਇਲਾਵਾ ਜਿਹੜੀਆਂ ਤਬਦੀਲੀਆਂ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਹੋ ਰਹੀਆਂ ਹੈਗੀਆਂ ਜਿਹੜੇ ਬੱਚੇ ਹੈ ਜਦੋਂ ਇਹਨਾਂ ਨੂੰ ਅਸੀਂ ਸਕੂਲ ਪੜ੍ਹਨ ਲਾਉਂਦੇ ਹਾਂ ਤਾਂ ਉੱਥੇ ਪੰਜਾਬੀ ਭਾਸ਼ਾ 'ਤੇ ਬਿਲਕੁਲ ਹੀ ਪੰਜਾਬੀ ਬੋਲਣ 'ਤੇ ਮਨਾਹੀ ਕੀਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਹੀ ਜਾਂ ਤਾਂ ਬੱਚੇ ਨੂੰ ਹਿੰਦੀ ਬੋਲਣ ਲਈ ਕਿਹਾ ਜਾਂਦਾ ਹੈ ਅਤੇ ਜਾਂ ਇੰਗਲਿਸ਼ ਬੋਲਣ ਲਈ ਕਿਹਾ ਜਾਂਦਾ ਸਾਡੇ ਆਮ ਬੋਲ ਬੋਲਚਾਲ ਦੀ ਭਾਸ਼ਾ ਵਿੱਚ ਵੀ ਕੁਛ ਲਫਜ਼ ਇਹੋ ਜਿਹੇ ਹੈ ਜੋ ਇੰਗਲਿਸ਼ ਦੇ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਪੰਜਾਬੀ ਭਾਸ਼ਾ ਦੇ ਖਤਮ ਹੁੰਦੇ ਜਾ ਰਹੇ ਨੇ ਜਿਵੇਂ ਸਾਡੇ ਸੱਭਿਆਚਾਰ ਰਿਲੇਟਿਡ ਚੀਜ਼ਾਂ ਜਿਵੇਂ ਪੌਣਾ ਆ ਗਿਆ ਤਬਲਾ ਅਤੇ ਤਪਣਾ ਅਤੇ ਖੁਰਚਣੀ ਕਾੜਨੀ ਅਤੇ ਲੱਕੜ ਦੀਆਂ ਮਧਾਣੀਆਂ ਅਤੇ ਚਾਟੀ ਅਤੇ ਇਹੋ ਜਿਹਾ ਜਿਵੇਂ ਸਾਗ ਸਾਗ ਦੇ ਵਿੱਚ ਆਲਣ ਪਾਉਣਾ ਇਸ ਲਫਜ਼ਾਂ ਨੂੰ ਬਹੁਤ ਜ਼ਿਆਦਾ ਜਿਹੜੇ ਬੱਚੇ ਜਾਂ ਵੱਡੇ ਬੱਚੇ ਜਾਂ ਛੋਟੇ ਬੱਚੇ ਉਹ ਨਹੀਂ ਜਾਣ ਦੇਗੇ ਅਤੇ ਜਦੋਂ ਅਸੀਂ ਸਕੂਲ ਦੇ ਵਿੱਚ ਵੀ ਬੱਚੇ ਨੂੰ ਲਾਉਂਦੇ ਹਾਂ ਤਾਂ ਉੱਥੇ ਵੀ ਬੱਚੇ ਨੂੰ ਪੰਜਾਬੀ ਬੋਲਣ 'ਤੇ ਮਨਾਹੀ ਹੋ ਰਹੀ ਹੈ ਇਸ ਕਰਕੇ ਸਾਡੀ ਪੰਜਾਬੀ ਭਾਸ਼ਾ ਪਿੱਛੇ ਹੁੰਦੀ ਜਾ ਰਹੀ ਹੈ ਅਤੇ ਇਸ ਨੂੰ ਅੱਗੇ ਵਧਾਉਣ ਲਈ ਵੀ ਨਹੀਂ ਲੋਕ ਆ ਰਹੇ ਜ਼ਿਆਦਾਤਰ ਲੋਕ ਇੰਗਲਿਸ਼ ਬੋਲਣ 'ਚ ਹੀ ਜਾਂ ਹਿੰਦੀ ਬੋਲਣ 'ਚ ਵੀ ਬੋਲਣ 'ਚ ਹੀ ਆਪ ਦਾ ਮਾਣ ਸਮਝਦੇ ਅਤੇ ਪੰਜਾਬੀ ਭਾਸ਼ਾ ਬੋਲਣ 'ਚ ਉਹਨਾਂ ਨੂੰ ਆਪ ਦੀ ਇੱਕ ਤਰ੍ਹਾਂ ਨਾਲ ਹੀਣਤਾ ਲੱਗਦੀ ਹੈਗੀ ਅਤੇ ਉਹ ਵੀ ਚੰਗਾ ਨਹੀਂ ਸਮਝਦੇ ਅੱਗੋਂ ਕਈ ਵਾਰ ਸੁਣਨ ਵਾਲਾ ਵੀ ਜਦੋਂ ਆਪਾਂ ਪੰਜਾਬੀ ਬੋਲਦੇ ਹਾਂ ਤਾਂ ਉਹ ਪੰਜਾਬੀ ਬੋਲਣ ਨੂੰ ਚੰਗਾ ਨਹੀਂ ਸਮਝਦਾ ਅਤੇ ਉਹ ਵੀ ਇਸ ਚੀਜ਼ ਨੂੰ ਵਧੀਆ ਨਹੀਂ ਸਮਝਦੇ ਅਤੇ ਪਰ ਇਹ ਗੱਲ ਵਧੀਆ ਨਹੀਂ ਸਾਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ ਅਤੇ ਜ਼ਿਆਦਾਤਰ ਸਕੂਲਾਂ 'ਚ ਵੀ ਬੱਚਿਆਂ ਨੂੰ ਇੰਗਲਿਸ਼ ਅਤੇ ਹਿੰਦੀ ਦੇ ਉੱਪਰ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ